ਸਤਿ ਸ਼੍ਰੀ ਅਕਾਲ ਜੀ ਤੁਸੀਂ ਬੇਅੰਤ ਸਿੰਘ ਗੱਲ ਕਰ ਰਹੇ ਹੋ ਅਸੀਂ ਓਲਾ ਐਪ ਤੋਂ ਕੈਬ ਆਨਲਾਈਨ ਕੈਬ ਬੁੱਕ ਕੀਤੀ ਸੀ ਅਸੀਂ ਡਰਾਈਵਰ ਨੂੰ ਸਵੇਰੇ ਪੰਜ ਵਜੇ ਦਾ ਟਾਈਮ ਦਿੱਤਾ ਸੀ ਅਸੀਂ ਸਾਢੇ ਪੰਜ ਵਜੇ ਦਿੱਲੀ ਜਾਣ ਲਈ ਰੇਲਵੇ ਸਟੇਸ਼ਨ 'ਤੇ ਪਹੁੰਚਣਾ ਹੈ ਅਸੀਂ ਉਹਨਾਂ ਨੂੰ ਪਤਾ ਅਤੇ ਸਮਾਂ ਬਹੁਤ ਚੰਗੀ ਤਰ੍ਹਾਂ ਦੱਸਿਆ ਸੀ ਹੁਣ ਪੰਜ ਵੱਜਣ 'ਚ ਪੰਜ ਮਿੰਟ ਰਹਿ ਗਏ ਹਨ ਪਰ ਉਹ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਸਾਡੀ ਦਿੱਲੀ ਦੀ ਟ੍ਰੇਨ ਸਾਢੇ ਪੰਜ ਵਜੇ ਤੁਰਨੀ ਹੈ ਸੋ ਅਸੀਂ ਉੱਥੇ ਦਸ ਮਿੰਟ ਪਹਿਲਾਂ ਵੀ ਪਹੁੰਚਣਾ ਹੈ ਅਸੀਂ ਉੱਥੇ ਦਸ ਮਿੰਟ ਪਹਿਲਾਂ ਪਹੁੰਚ ਕੇ ਆਪਦੀ ਥੋੜ੍ਹੀ ਬਹੁਤੀ ਸੈਟਿੰਗ ਕਰਨੀ ਹੈ ਅਤੇ ਕੁਝ ਖਾਣ ਨੂੰ ਚੀਜ਼ਾਂ ਵੀ ਲੈਣੀਆਂ ਹਨ ਤੁਸੀਂ ਜਲਦੀ ਤੋਂ ਜਲਦੀ ਆਪਣੇ ਡਰਾਈਵਰ ਨਾਲ ਗੱਲ ਕਰਕੇ ਸਾਨੂੰ ਦੱਸੋ ਵੀ ਉਹ ਕਿੱਥੇ ਪਹੁੰਚੇ ਹਨ ਅਤੇ ਉਹ ਕਦੋਂ ਤੱਕ ਸਾਡੇ ਕੋਲ ਪਹੁੰਚਣਗੇ ਸਾਨੂੰ ਉਹਨਾਂ ਦੇ ਲੇਟ ਪਹੁੰਚਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਵੀ ਪਵੇਗਾ ਸਾਡੀ ਦਿੱਲੀ ਜਾਣ ਵਾਲੀ ਟ੍ਰੇਨ ਵੀ ਮਿਸ ਹੋ ਜਾਵੇਗੀ ਜਿੱਥੇ ਮੈਂ ਪਹੁੰਚਣਾ ਹੈ ਉੱਥੇ ਮੇਰਾ ਇੰਟਰਵਿਊ ਵੀ ਹੈ ਅਗਰ ਮੈਂ ਇੰਟਰਵਿਊ 'ਚ ਟਾਈਮ ਨਾਲ ਨਹੀਂ ਪਹੁੰਚੀ ਤਾਂ ਮੈਨੂੰ ਫਿਊਚਰ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਜੇ ਮੈਂ ਇੰਟਰਵਿਊ 'ਚ ਇੰਟਰਵਿਊ ਵਿੱਚ ਟਾਈਮ ਨਾਲ ਨਹੀਂ ਪਹੁੰਚਦੀ ਤਾਂ ਮੈਂ ਮੇਰੇ ਹੱਥੋਂ ਮੇਰੀ ਆਉਣ ਵਾਲੀ ਜੋਬ ਵੀ ਚਲੀ ਜਾਵੇਗੀ ਮੈਨੂੰ ਉਸ ਜੋਬ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਕਰਕੇ ਮੇਰਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਤੁਸੀਂ ਆਪਣੇ ਡਰਾਈਵਰ ਨੂੰ ਛੇਤੀ ਕੋਲ ਕਰਕੇ ਦਿੱਤੀ ਗਈ ਜਗ੍ਹਾ 'ਤੇ ਸਥਾਨ ਦੇ ਪਹੁੰਚਣ ਦੀ ਨੁਮਾਇਸ਼ ਕੀਤੀ ਜਾਵੇ ਜੋ ਕਿ ਓਹ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚਣ ਅਤੇ ਅਸੀਂ ਜਲਦੀ ਤੋਂ ਜਲਦੀ ਸਾਡੇ ਦਿੱਤੇ ਗਏ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੀਏ ਕਿਰਪਾ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜਿਸ ਨਾਲ ਤੁਹਾਡਾ ਅਤੇ ਸਾਡਾ ਸਾਡਾ ਨੁਕਸਾਨ ਹੋਣ ਤੋਂ ਬਚ ਜਾਵੇ ਥੈਂਕਸ